ਹੈਲੋ ਹਾਂ ਵੀਰ ਭਾਈ ਕੀ ਹਾਲ ਆ ਕੀ ਚੱਲਦਾ ਅੱਜ ਕੱਲ੍ਹ ਅਸੀਂ ਨਾ ਆਪਣੇ ਬਰਡੇ 'ਤੇ ਸੁਖਮ ਢਾਬੇ ਜਾਣਾ ਹੈਗਾ ਉੱਧਰ ਹੀ ਆਪਾਂ ਸੋਚ ਰਹੇ ਹਾਂ ਪਾਰਟੀ ਕਰਾਂਗੇ ਤੁਸੀਂ ਪਿੱਛੇ ਉਸ ਢਾਬੇ 'ਤੇ ਗਏ ਸੀਗੇ ਮੈਨੂੰ ਦੱਸਿਓ ਜੇ ਤੁਹਾਨੂੰ ਉੱਧਰ ਦੀ ਰੋਟੀ ਕਿੱਦਾਂ ਲੱਗੀ ਅਸੀਂ ਤਾਂ ਸੋਚ ਰਹੇ ਹਾਂ ਮਟਰ ਪਨੀਰ ਦਾਲ ਮੱਖਣੀ ਅਤੇ ਇੱਦਾਂ ਹੀ ਵੇਜੀਟੇਰੀਅਨ ਡਿਸ਼ਿਜ਼ ਮੰਗਾ ਲਈਏ ਤੁਸੀਂ ਕੀ ਖਾਧਾ ਸੀਗਾ ਐਂ ਮੈਨੂੰ ਦੱਸਿਓ ਜੇ ਰੋਟੀ ਕਿੱਦਾਂ ਲੱਗੀ ਸੀਗੀ ਸਵਾਦ ਹੈਗੀ ਨਹੀਂ ਹੈਗੀ ਆ ਦੱਸਿਓ ਅਤੇ ਉੱਧਰ ਦੀ ਸਰਵਿਸ ਕਿੱਦਾਂ ਹੈਗੀ ਐਂ ਨਾ ਹੋਏ ਆਪਾਂ ਬੈਠੇ ਰਹੀਏ ਅਤੇ ਰੋਟੀ ਆਉਣ 'ਤੇ ਘੰਟਾ ਲੱਗ ਜੇ ਤੁਸੀਂ ਮੈਨੂੰ ਐਂ ਰੇਟਿੰਗ ਚੈੱਕ ਕਰ ਰਿਹਾ ਸੀਗਾ ਇਹਦੀ ਰੇਟਿੰਗ ਤਾਂ ਸਾਢੇ ਤਿੰਨ ਦੱਸਦੀ ਆ ਪਰ ਸਰਵਿਸ ਤਾਂ ਕਿਸੇ ਬੰਦੇ ਨੇ ਥੋੜ੍ਹਾ ਜਿਹਾ ਦੱਸਿਆ ਹੈ ਥੋੜ੍ਹੀ ਜੀ ਠੀਕ ਨਹੀ ਏ ਅਤੇ ਤੁਸੀਂ ਆਪਣਾ ਐੱਕਸਪੀਰੀਐਂਸ ਮੈਨੂੰ ਸ਼ੇਅਰ ਕਰੋ ਕਿ ਤੁਹਾਨੂੰ ਉੱਥੇ ਰੋਟੀ ਕਿੱਦਾਂ ਲੱਗੀ ਜੇਕਰ ਤੁਸੀਂ ਮੈਨੂੰ ਦੱਸੋਗੇ ਤਾਂ ਫਿਰ ਅਸੀਂ ਉੱਧਰ ਦੀ ਪਾਰਟੀ ਰ ਕਰਾਂਗੇ ਤੁਸੀਂ ਵੀ ਉੱਧਰ ਜ਼ਰੂਰ ਆਇਓ ਜੀ